ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਿਹਾ ਜੀ ਜੀ ਬਿਲਕੁਲ ਜੀ ਬਿਲਕੁਲ ਦੱਸਦੇ ਹਾਂ ਜੀ ਪਰ ਮੇਰਾ ਨਾਮ ਗੌਰਵ ਧੀਮਾਨ ਹੈ ਜੀ ਪਹਿਲਾਂ ਆਪਣਾ ਨਾਂ ਤਾਂ ਦੱਸੋ ਜੀ ਕੀ ਨਾਂ ਹੈ ਤੁਹਾਡਾ ਅੱਛਾ ਅੱਛਾ ਜੀ ਦੇਖੋ ਜੀ ਵੈਸੇ ਤਾਂ ਮਸ਼ਹੂਰ ਨੇ ਪੰਜਾਬ 'ਚ ਪਰ ਸਭ ਤੋਂ ਮਸ਼ਹੂਰ ਹੈ ਜੀ ਦਾਰਾ ਸਿੰਘ ਜੀ ਦੇਖੋ ਜੀ ਉਹਨਾਂ ਨੇ ਹਨੂੰਮਾਨ ਜੀ ਦਾ ਰੋਲ ਕੀਤਾ ਸੀ ਅਤੇ ਉਹ ਤੋਂ ਉੱਪਰ ਤਾਂ ਕੋਈ ਹੋ ਨਹੀਂ ਸਕਦਾ ਜੀ ਉਹ ਸਭ ਤੋਂ ਬੈਸਟ ਰੋਲ ਹੈ ਅਤੇ ਉਸ ਤੋਂ ਬਾਅਦ ਆ ਜਾਂਦੇ ਨੇ ਬੋਬੀ ਦਿਓਲ ਸਨੀ ਦਿਓਲ ਅਤੇ ਬੋਬੀ ਦਿਓਲ ਹੁਣ ਦੇ ਟਾਈਮ 'ਤੇ ਬੜੇ ਮਸ਼ਹੂਰ ਹਨ ਕਿਉਂਕਿ ਉਹਨਾਂ ਨੇ ਐਨੀਮਲ ਮੂਵੀ 'ਚ ਇੱਕ ਸੋਹਣਾ ਕਿਰਦਾਰ ਕੀਤਾ ਸੀ ਅਤੇ ਬੜਾ ਤਗੜਾ ਵੀ ਸੀ ਦੇਖੋ ਜੀ ਹੋਰ ਵੀ ਬਥੇਰੀਆਂ ਨੇ ਜਿਵੇਂ ਮਨਕੀਰਤ ਔਲਖ ਹੈਗਾ ਗਿੱਪੀ ਗਰੇਵਾਲ ਦ ਦਿਲਜੀਤ ਦੋਸਾਂਝ ਸਭ ਤੋਂ ਮਸ਼ਹੂਰ ਹੈ ਜੀ ਸਭ ਤੋਂ ਏ ਵਨ ਕਲਾਕਾਰ ਹੈ ਵਧੀਆ ਹੈ ਜੀ ਉਹਨੂੰ ਤੁਸੀਂ ਵਿਜਿਟ ਕਰ ਸਕਦੇ ਹੋ ਜੀ ਓਕੇ ਬਾਏ ਓਕੇ ਬਾਏ